ਪਾਣੀ ਇੱਕ ਇੱਕ ਪਾਣੀ ਦੀ ਮਹੱਤਤਾ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ ਪਾਣੀ ਇੱਕ ਇਸ ਤਰ੍ਹਾਂ ਦਾ ਤਰਲ ਪਦਾਰਥ ਹੈ ਜੋ ਸਾਡੇ ਜੀਵਨ ਵਿੱਚ ਇੱਕ ਬਹੁਤ ਮਹੱਤਵ ਰੱਖਦਾ ਹੈ ਪਾਣੀ ਤੋਂ ਬਗੈਰ ਧਰਤੀ 'ਤੇ ਜੀਵ ਦਾ ਰਹਿਣਾ ਬਹੁਤ ਮੁਸ਼ਕਲ ਹੈ ਪਾਣੀ ਜਿਹੜਾ ਹੈ ਅਸੀਂ ਘਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਖਾਣਾ ਬਣਾਉਣ ਵਾਸਤੇ ਘਰ ਦੀ ਸਫਾਈ ਵਾਸਤੇ ਵਰਤਦੇ ਹਾਂ ਅਤੇ ਪਸ਼ੂਆਂ ਦੇ ਵਾਸਤੇ ਪਾਣੀ ਪਿਲਾਉਣ ਵਾਸਤੇ ਨਵਾਉਣ ਵਾਸਤੇ ਵਰਤਦੇ ਹਾਂ ਫਿਰ ਅਸੀਂ ਆਪਣੇ ਘਰ ਵਿੱਚ ਟਰੈਕਟਰ ਟਰਾਲੀਆਂ ਦੀ ਸਫ਼ਾਈ ਕਰਨ ਵਾਸਤੇ ਵੀ ਇਸ ਨੂੰ ਵਰਤਦੇ ਹਾਂ ਪਾਣੀ ਦੀ ਸਿੰਚਾਈ ਦੇ ਨਾਲ ਹੀ ਸਾਨੂੰ ਖਾਣ ਵਾਸਤੇ ਸਭ ਕੁਝ ਮਿਲਦਾ ਹੈ ਜਿਸ ਤਰ੍ਹਾਂ ਕਿ ਸਬਜ਼ੀਆਂ ਫਲ ਅਨਾਜ ਇਹ ਸਭ ਕੁਛ ਪਾਣੀ ਦੀ ਦੇਣ ਨਾਲ ਹੀ ਹੁੰਦੇ ਹਨ ਉਸ ਤਰ੍ਹਾਂ ਇਸ ਤੋਂ ਬਗੈਰ ਜੀਉਣਾ ਧਰਤੀ 'ਤੇ ਅਸੰਭਵ ਹੈ